ਇੱਕ ਹਜ਼ਾਰ ਪੰਜ ਸੌ ਪੱਚੀ ਪੰਜਾਹ ਹਜ਼ਾਰ ਤਿੰਨ ਸੌ ਚਾਲੀ ਸੱਤ ਹਜ਼ਾਰ ਦੋ ਸੌ ਛੱਬੀ ਪੈਂਹਠ ਹਜ਼ਾਰ ਦੋ ਸੌ ਚਾਲੀ ਨੌਂ ਲੱਖ ਅਠਾਈ ਹਜ਼ਾਰ ਚਾਰ ਸੌ ਛੱਤੀ